ਹਰ ਸਥਾਨ ਅਤੇ ਸਮਾਜ ਵਿੱਚ ਕੁਝ ਵਹਿਮਾਂ ਅਤੇ ਭਰਮ ਹੁੰਦੇ ਹਨ ਜੋ ਕਿ ਲੋਕਾਂ ਵਿੱਚ ਮਜਬੂਤੀ ਨਾਲ ਵਿਸ਼ੇ ਵਿਸ਼ਵਾਸ ਕੀਤੇ ਜਾਂਦੇ ਹਨ ਮੇਰੇ ਇਲਾਕੇ ਵਿੱਚ ਵੀ ਕਈ ਐਸੇ ਧਾਰ ਧਾਰਨਾਵਾਂ ਹਨ ਜੋ ਲੋਕਾਂ ਨੂੰ ਅਜੇ ਵੀ ਪ੍ਰਭਾਵਿਤ ਕਰਦੀਆਂ ਹਨ ਇੱਕ ਵਹਿਮ ਜੋ ਬਹੁਤ ਹੀ ਆਮ ਹੈ ਉਹ ਹੈ ਪਹਿਲੀ ਪਤੰਗ ਸਾਡੀ ਲਈ ਪਹਿਲੀ ਪਤੰਗ ਸਾਡੇ ਲਈ ਸਗੋਂ ਸ਼ਗੁ ਸ਼ਗੁਨ ਨਹੀਂ ਹੈ ਜਦੋਂ ਪਹਿਲੀ ਪਤੰਗ ਉੱਡਦੀ ਹੈ ਤਾਂ ਕੋਈ ਤਾਂ ਕਈ ਲੋਕ ਇਸਨੂੰ ਘਰ ਦੇ ਕਿਸੇ ਵਿਅਕਤੀ ਲਈ ਬੁਰਾ ਸ਼ ਸ਼ਗੁਨ ਸਮਝਦੇ ਹਨ ਅਤੇ ਇਸ ਇਸਦੇ ਬਾਅਦ ਪਤੰਗ ਉਡਾਉਣ ਵਿੱਚ ਬੜੀ ਸੰਤੁਸ਼ਟੀ ਮਹਿਸੂਸ ਨਹੀਂ ਕਰਦੇ ਇੱਕ ਹੋਰ ਵਹਿਮ ਹੈ ਵਹਿਮ ਆ ਜੋ ਇਸ ਇਲਾਕੇ ਵਿੱਚ ਕਾਫ਼ੀ ਮੰਨਿਆ ਜਾਂਦਾ ਹੈ ਉਹ ਹੈ ਚਾਨਣੀ ਰਾਤ ਨੂੰ ਯਾਤਰਾ ਕਰਨ ਮੰਗਲਨਹੀਣ ਹੈ ਲੋਕਾਂ ਦੇ ਇਹ ਮੰਨਣ ਨਾਲ ਮੰਨਣਾ ਹੀ ਕਿ ਚਾਨਣੀ ਰਾਤ ਵਿੱਚ ਸਫ਼ਰ ਕਰਨ ਨਾਲ ਘਟਨਾਵਾਂ ਜਾਂ ਮੁਸੀਬਤਾਂ ਆ ਸਕਦੀਆਂ ਹਨ ਜਿਸ ਕਰਕੇ ਕਈ ਵਾਰ ਲੋਕਾਂ ਲੋਕ ਇਸ ਸਮੇਂ ਸਫਰ ਕਰਨ ਤੋਂ ਜ਼ਿਆਦਾ ਔਖਾ ਮਹਿਸੂਸ ਕਰਦੇ ਹਨ ਇੱਕ ਹੋਰ ਆਮ ਭਰਮ ਹੈ ਹੈ ਇਹ ਕਿ ਚੰਗੀ ਚੰ ਚ ਚੰਦੀ ਦੀ ਚੁੰਨੜੀ ਕਿਸੇ ਨੂੰ ਦਿ ਦਿੰਦੇ ਸਮੇਂ ਕਈ ਕੋਈ ਪਲਟਣਾ ਨਹੀਂ ਚਾਹੀਦਾ ਨਹੀਂ ਤਾਂ ਇਸ ਵਿ ਕਿਸੇ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਧੰਨਵਾਦ